ਜੇਕਰ ਮੇਰੇ ਪਿੰਡ ਦੇ ਕਿਸੇ ਵਿਅਕਤੀ ਨੂੰ ਸੱਪ ਡੰਗ ਲਵੇ ਤਾਂ ਮੈਂ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਸੱਪ ਤੋਂ ਦੂਰ ਲੈ ਕੇ ਜਾਵਾਂਗੀ ਅਤੇ ਫਿਰ ਡੰਗਣ ਵਾਲੀ ਜਗ੍ਹਾ ਤੋਂ ਉੱਪਰ ਕੱਪੜਾ ਬੰਨ ਦੇਵਾਂਗੀ ਤਾਂ ਜੋ ਜਹਿਰ ਸਰੀਰ ਵਿੱਚ ਨਾ ਜਾਵੇ ਫਿਰ ਮੈਂ ਡੰਗਣ ਵਾਲੀ ਜਗ੍ਹਾ ਨੂੰ ਸਾਬਣ ਅਤੇ ਪਾਣੀ ਨਾਲ ਸਾਫ਼ ਕਰਾਂਗੀ ਫਿਰ ਮੈਂ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ ਉਸ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਵਾਂਗੀ ਅਤੇ ਉਸ ਦਾ ਇਲਾਜ ਕਰਵਾਵਾਂਗੀ ਤਾਂ ਜੋ ਉਸ ਵਿਅਕਤੀ ਦੀ ਜਾਨ ਬਚ ਸਕੇ ਇਸ ਤਰ੍ਹਾਂ ਮੈਂ ਉਸਦੀ ਮਦਦ ਕਰਾਂਗੀ ਧੰਨਵਾਦ